ਬੜੇ ਲੰਬੇ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਅਪਰਾਧ ਬਹੁਤ ਹੀ ਤੇਜ਼ ਗਤੀ ਨਾਲ ਵੱਧ ਰਿਹਾ ਜਾ ਰਿਹਾ ਹੈ ਅਪਰਾਧ ਵਧਣ ਨਾਲ ਸਾਰੇ ਲੋਕ ਬਹੁਤ ਹੀ ਡਰ ਅਤੇ ਭੈਅ ਦੇ ਵਿੱਚ ਹਨ ਔਰਤਾਂ ਘਰ ਦੇ ਵਿੱਚੋਂ ਨਿਕਲਣ ਲੱਗੇ ਵੀ ਸੌ ਵਾਰੀ ਸੋਚਦੀਆਂ ਹਨ ਕਿ ਅਸੀਂ ਇਹ ਕੰਮ ਕਰਨ ਲਈ ਬਾਹਰ ਜਾਈਏ ਜਾਂ ਨਾ ਜਾਈਏ ਇੱਥੇ ਤੱਕ ਕਿ ਬੰਦੇ ਵੀ ਬਾਹਰ ਨਿਕਲਣ ਲਈ ਡਰ ਮਹਿਸੂਸ ਕਰਦੇ ਹਨ ਕਿਉਂਕਿ ਜਾਨਲੇਵਾ ਹੱਤਿਆ ਇੱਥੇ ਬਹੁਤ ਸਾਰੀਆਂ ਵੱਧਦੀਆਂ ਜਾ ਰਹੀਆਂ ਹਨ ਅਤੇ ਲੁੱਟਾਂ ਖੋਹਾਂ ਦਾ ਤਾਂ ਕੁਛ ਕਹਿਣਾ ਹੀ ਨਹੀਂ ਹੈ ਉਹ ਵੀ ਬਹੁਤ ਹੀ ਵੱਡੇ ਪੱਧਰ 'ਤੇ ਜਾ ਚੁੱਕੀਆਂ ਹਨ ਪਤਾ ਵੀ ਨਹੀਂ ਲੱਗਦਾ ਕਿ ਲੁਟੇਰੇ ਕਿਸ ਵਕਤ ਲੁੱਟ ਕੇ ਚੀਜ਼ਾਂ ਲੈ ਜਾਂਦੇ ਹਨ ਸੋ ਇਹਦੇ ਦੋ ਕਾਰਨ ਹਨ ਗਰੀਬੀ ਅਤੇ ਬੇਰੁਜ਼ਗਾਰੀ ਇਹਨੂੰ ਆਪਾਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਪੜ੍ਹੇ ਲਿਖੇ ਅੱਜ ਕੱਲ੍ਹ ਬੇਰੁਜ਼ਗਾਰ ਹਨ ਅਤੇ ਜਦੋਂ ਉਹ ਬੇਰੁਜ਼ਗਾਰ ਹਨ ਤਾਂ ਗਰੀਬੀ ਵੱਧ ਰਹੀ ਹੈ ਉਹਨਾਂ ਉਹਨਾਂ ਕੋਲ ਨੌਕਰੀ ਨਹੀਂ ਹੈ ਉਹ ਬੇਰੁਜ਼ਗਾਰ ਹਨ ਬੇਰੁਜ਼ਗਾਰ ਹੋਣ ਕਰਕੇ ਉਹ ਗਰੀਬੀ ਦਾ ਸਾਹਮਣਾ ਕਰ ਰਹੇ ਹਨ ਗਰੀਬੀ ਹੋਣ ਕਰਕੇ ਹੁਣ ਉਹਨਾਂ ਨੂੰ ਕੋਈ ਨਾ ਕੋਈ ਸਟੈਪ ਤਾਂ ਇਹੋ ਜਿਹਾ ਲੈਣਾ ਪਵੇਗਾ ਜਿਹਦੇ ਨਾਲ ਉਹ ਆਪਣੀ ਡੇਲੀ ਨੀਡਜ ਨੂੰ ਪੂਰੀਆਂ ਕਰ ਸਕਣ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਹੈ ਜਿਸ ਤਰ੍ਹਾਂ ਉਹਨਾਂ ਨੇ ਰੋਟੀ ਖਾਣੀ ਹੈ ਜਾਂ ਕੱਪੜੇ ਲੈਣੇ ਹਨ ਜਾਂ ਸੌਣ ਨੂੰ ਛੱਤ ਚਾਹੀਦੀ ਹੈ ਜਾਂ ਕੋਈ ਡੇਲੀ ਖੇ ਖਰਚੇ ਹੁੰਦੇ ਹਨ ਉਹਨਾਂ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਚਾਹੀਦਾ ਹੈ ਸੋ ਉਹ ਅਪਰਾਧ ਵਾਲੇ ਪਾਸੇ ਤੁਰਦੇ ਜਾ ਰਹੇ ਹਨ ਦੇਖਿਆ ਜਾਵੇ ਤਾਂ ਇੱਥੇ ਦਾ ਸਿਸਟਮ ਬਹੁਤ ਖਰਾਬ ਹੈ ਸਾਰੇ ਲੋਕ ਕਮਿਸ਼ਨ ਬੇਸ ਹੀ ਚਲਦੇ ਹਨ ਸਾਰੇ ਕਰਮਚਾਰੀ ਬਹੁਤ ਕ੍ਰਪਸ਼ਨ ਦੇ ਵਿੱਚ ਫਸ ਚੁੱਕੇ ਹਨ ਸੋ ਇਸ ਕਰਕੇ ਅਪਰਾਧ ਵੱਧਦੇ ਜਾ ਰਹੇ ਹਨ ਜਿਸ ਦੇ ਨਾਲ ਹੀ ਸਾਰੇ ਸ਼ਹਿਰ ਦਾ ਮਾਹੌਲ ਬਹੁਤ ਹੀ ਡਰ ਅਤੇ ਭੈਅ ਵਾਲਾ ਬਣ ਚੁੱਕਾ ਹੈ ਅਗਰ ਇਸਨੂੰ ਚੇਂਜ ਕਰਨਾ ਹੈ ਜਾਂ ਇਸ ਵਿੱਚ ਤਬਦੀਲੀ ਲੈ ਕੇ ਆਉਣੀ ਹੈ ਤਾਂ ਸਾਨੂੰ ਸਿਸਟਮ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਰੂਲਸ ਐਨੇ ਕੁ ਜ਼ਿਆਦਾ ਸਖਤ ਕਰਨੇ ਚਾਹੀਦੇ ਹਨ ਕਿ ਲੁਟੇਰਿਆਂ ਨੂੰ ਕੋਈ ਵੀ ਕਰਾਈਮ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣਾ ਪਵੇ ਹੋਰ ਪਾਸੇ ਦੇਖੀਏ ਤਾਂ ਨੌਜਵਾਨ ਡਿਪਰੈਸ਼ਨ ਵਿੱਚ ਜਾ ਰਹੇ ਹਨ ਬੇਰੁਜ਼ਗਾਰੀ ਕਰਕੇ ਸੋ ਗੋਂਵਮੈਂਟ ਨੂੰ ਕੁਛ ਇਹੋ ਜਿਹੇ ਉਹਨਾਂ ਲਈ ਇੰਪਲੋਏਮੈਂਟ ਔਪਰਚੁਨਿਟੀਜ਼ ਲੈ ਕੇ ਆਉਣੀਆਂ ਚਾਹੀਦੀਆਂ ਹਨ ਜਿਹਦੇ ਨਾਲ ਕਿ ਉਹ ਵਧੀਆ ਆਮਦਨ ਕਮਾ ਸਕਣ ਅਤੇ ਆਪਣੇ ਖਰਚਿਆਂ ਨੂੰ ਚਲਾ ਸਕਣ ਅਤੇ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਸਕਣ